ਭਾਰਤ ਮੁੱਢ ਤੋਂ ਹੀ ਗੁਲਾਮਾਂ ਦਾ ਦੇਸ਼ ਰਿਹਾ ਹੈ ਜੋ ਵੀ ਸ਼ਾਸਕ ਇਸ ਅੰਦਰ ਦਾਖਲ ਹੋਇਆ ਉਸ ਨੇ ਭਾਰਤ ਨੂੰ ਗੁਲਾਮ ਬਣਾਇਆ ਭਾਰਤ ਦੀ ਆਜ਼ਾਦੀ ਦੀ ਲਹਿਰ ਬਾਰੇ ਜੇਕਰ ਕਹਿਣਾ ਹੋਵੇ ਤਾਂ ਮੇਰਾ ਸਮਝਣਾ ਇਹ ਹੈ ਕਿ ਇਸ ਦੀ ਸ਼ੁਰੂਆਤ ਤਾਂ ਸਿੱਖ ਧਰਮ ਤੋਂ ਹੀ ਹੋ ਗਈ ਸੀ ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਦੇਵ ਨੇ ਜਬਰ ਜ਼ੁਲਮ ਬਾਰੇ ਡੱਟ ਕੇ ਬੋਲਿਆ ਉਹਨਾਂ ਤੋਂ ਬਾਅਦ ਦੇ ਗੁਰੂਆਂ ਨੇ ਵੀ ਬਹੁਤ ਸੰਘਰਸ਼ ਕੀਤਾ ਤਾਂ ਜੋ ਜ਼ੁਲਮ ਨੂੰ ਖ਼ਤਮ ਕੀਤਾ ਜਾ ਸਕੇ ਇਸ ਦੇ ਬਾਅਦ ਖਾਲਸਾ ਰਾਜ ਦੀ ਨੀਂਹ ਰੱਖੀ ਗਈ ਖ਼ਾਲਸਾ ਰਾਜ ਦੇ ਆਉਣ ਨਾਲ ਜਬਰ ਜ਼ੁਲਮ ਦੇ ਖਿਲਾਫ ਲੋਕਾਂ ਨੇ ਵੀ ਡੱਟ ਕੇ ਸਾਹਮਣਾ ਕੀਤਾ ਇਸ ਤੋਂ ਬਾਅਦ ਅਠਾਰਾਂ ਸੌ ਸਤਵੰਜਾ ਦੇ ਵਿਦਰੋਹ ਨੇ ਨਵੀਂ ਚਿੰਗਾਰੀ ਭੜਕਾ ਦਿੱਤੀ ਅਤੇ ਕਈ ਸਿਰ ਕੱਢ ਜੋਧਿਆਂ ਨੇ ਇਸ ਸੰਘਰਸ਼ ਵਿੱਚ ਹਿੱਸਾ ਲਿਆ ਇਸ ਵਿੱਚ ਭਗਤ ਸਿੰਘ ਊਧਮ ਸਿੰਘ ਰਾਜਗੁਰੂ ਅਤੇ ਸੁਖਦੇਵ ਵਰਗੇ ਨਾਮ ਜ਼ਿਆਦਾ ਪ੍ਰਚਲਿਤ ਹੋਏ ਹਨ